ਹਾਂਜੀ ਦੂਰੋਂ ਦੂਰੋਂ ਜਿਹੜੇ ਨੇ ਲੋਕ ਇੱਥੇ ਘੁੰਮਣ ਆਉਂਦੇ ਨੇ ਇਸ ਧਾਰਮਿਕ ਸਥਾਨ ਨੂੰ ਦੇਖਣ ਆਉਂਦੇ ਨੇ ਔਰ ਇੱਥੇ ਇਸ਼ਨਾਨ ਕਰਨ ਦੇ ਲਈ ਆਉਂਦੇ ਨੇ ਇਸ ਤੋਂ ਇਲਾਵਾ ਸਾਡੇ ਜਿਹੜਾ ਨਜ਼ਦੀਕ ਇੱਕ ਹੋਰ ਜਿਹੜੇ ਆ ਜਗ੍ਹਾ ਹੈਗੀ ਆ ਜਿਹਨੂੰ ਕਿ ਫਿਸ਼ ਪਾਰਕ ਬੋਲਿਆ ਜਾਂਦਾ ਆ ਇਹ ਵੀ ਸਥਾਨ ਬਹੁਤ ਹੀ ਦਿਲਚਸਪ ਆ ਲੋਕ ਜਿਹੜਾ ਵੀ ਕੋਈ ਬਾਹਰੋਂ ਆਉਂਦਾ ਆ ਉਹ ਇਸ ਸਥਾਨ ਦੇ ਵਿੱਚ ਸੈਰ ਸਪਾਟਾ ਕਰਨ ਦੇ ਲਈ ਜ਼ਰੂਰ ਜਾਂਦਾ ਆ ਇਸ ਸਥਾਨ 'ਤੇ ਆਪਣੀ ਸੋਹਣੀਆਂ ਸੋਹਣੀਆਂ ਜਿਹੜਾ ਉਹ ਤਸਵੀਰਾਂ ਖਿਚਵਾਉਂਦਾ ਆ ਆਪਣੀਆਂ ਯਾਦਾਂ ਨੂੰ ਜਿਹੜਾ ਆ ਉਹ ਰਿਕੋਰਡ ਕਰਕੇ ਆਪਣੇ ਕੋਲ ਰੱਖਦਾ ਆ ਸੋ ਇਸ ਤੋਂ ਇਲਾਵਾ ਸਾਡੇ ਖੇਤਰ ਦੇ ਵਿੱਚ ਹੋਰ ਵੀ ਬਹੁਤ ਮਹੱਤਵ ਮਹੱਤਵਪੂਰਨ ਸਥਾਨ ਨੇ ਜੋ ਦੇਖਣ ਦੇ ਵਿੱਚ ਬਹੁਤ ਹੀ ਦਿਲਚਸਪ ਨੇ ਅਤੇ ਜਿੱਥੇ ਦੂਰੋਂ ਦੂਰੋਂ ਲੋਕ ਦੇਖਣ ਆਉਂਦੇ ਨੇ ਅਤੇ ਸੈਰ ਸਪਾਟਾ ਕਰਨ ਦੇ ਲਈ ਆਉਂਦੇ ਨੇ